ਪੰਜ ਹਜ਼ਾਰ ਚਾਰ ਸੌ ਤੀਹ ਦੋ ਹਜ਼ਾਰ ਪੰਜ ਸੌ ਪੰਜ ਛੇ ਹਜ਼ਾਰ ਤਿੰਨ ਸੌ ਤੇਰਾਂ ਸੱਠ ਲੱਖ ਚਾਲੀ ਹਜ਼ਾਰ ਛੇ ਸੌ ਪੰਦਰਾਂ ਅੱਠ ਲੱਖ ਬਾਹਠ ਹਜ਼ਾਰ ਨੌ ਸੌ ਪੱਚੀ